ਹੈਲੋ ਭਾਰਤ ਵਿੱਚ ਸਿਹਤ ਪ੍ਰਣਾਲੀ ਬਹੁਤ ਹੀ ਵਧੀਆ ਹੈ ਇੱਥੇ ਕੋਈ ਦਿੱਕਤ ਨਹੀਂ ਹੈ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ ਇਹ ਦੂਸਰੇ ਦੇਸ਼ਾਂ ਨਾਲੋਂ ਬਹੁਤ ਵਧੀਆ ਹੈ ਇੱਥੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਸਾਡੇ ਬਹੁਤ ਹੀ ਸਟਾਫ ਹੈ ਸਾਡੇ ਆਲੇ ਦੁਆਲੇ ਜਿਸ ਤਰ੍ਹਾਂ ਮੁਹੱਲਾ ਕਲੀਨਿਕ ਖੋਲ੍ਹੇ ਹਨ ਸਾਨੂੰ ਉਹਨਾਂ ਦਾ ਵੀ ਬਹੁਤ ਸੁਵਿਧਾ ਮਿਲੀ ਹੈ ਅਤੇ ਬਹੁਤ ਹੀ ਫਾਇਦਾ ਹੈ ਅਤੇ ਸਾਨੂੰ ਇੱਥੇ ਸਿਰਫ ਲੰਬੀਆਂ ਕਤਾਰਾਂ ਵਿੱਚ ਜਾ ਕੇ ਰੁਕਣਾ ਪੈਂਦਾ ਹੈ ਜਿੱਦਾਂ ਸਾਨੂੰ ਪਰਚੀ ਕਟਾਉਣ 'ਤੇ ਬਹੁਤ ਸਮਾਂ ਲੱਗਦਾ ਹੈ ਸਾਨੂੰ ਉਹ ਨਾ ਲੱਗੇ ਸਾਡੇ ਵਾਸਤੇ ਥੋੜ੍ਹਾ ਕੰਮ ਸੌਖਾ ਹੋ ਜਾਵੇ ਅਤੇ ਸਾਡੇ ਇੱਧਰ ਵੋਸ਼ਰੂਮ ਬਹੁਤ ਗੰਦੇ ਹਨ ਸਾਨੂੰ ਸਫਾਈ ਕਰਮਚਾਰੀਆਂ ਦੀ ਲੋੜ ਹੈ ਬਾਕੀ ਸਾਡੇ ਡੋਕਟਰ ਬਹੁਤ ਵਧੀਆ ਹਨ ਇਲਾਜ ਬਹੁਤ ਵਧੀਆ ਕਰਦੇ ਸਨ ਸਾਨੂੰ ਇੱਥੇ ਕੋਈ ਵੀ ਕਮੀ ਨਹੀਂ ਹੈਗੀ ਅਤੇ ਬਸ ਸਾਨੂੰ ਸਿਰਫ ਕਰਮਚਾਰੀਆਂ ਦੀ ਜ਼ਰੂਰਤ ਹੈਗੀ ਐ ਬਹੁਤ ਵਧੀਆ ਮੁਹੱਲਾ ਕਲੀਨਿੰਗ ਵਿੱਚ ਵੀ ਬਹੁਤ ਵਧੀਆ ਇਲਾਜ ਹੁੰਦਾ ਹੈ ਹੋਰ ਸਾਨੂੰ ਇੱਥੇ ਕੋਈ ਦਿੱਕਤ ਨਹੀਂ ਹੈਗੀ ਸਿਰਫ ਸਾਨੂੰ ਸਫਾਈ ਕਰਮਚਾਰੀਆਂ ਦੀ ਲੋੜ ਹੈਗੀ ਆ ਬਹੁਤ ਗੰਦਗੀ ਹੁੰਦੀ ਆ ਬਾਥਰੂਮਾਂ ਵਿੱਚ ਸਰਕਾਰੀਆਂ ਵਿੱਚ